ਇੱਕ ਵਾਰ ਦੀ ਗੱਲ ਹੈ ਕਿ ਮੇਰੀ ਭੈਣ ਦੀ ਭੈਣ ਦਾ ਜਨਮਦਿਨ ਸੀ ਜਿਸਦੀਆਂ ਸਹੇਲੀਆਂ ਆਈਆਂ ਹੋਈਆਂ ਸਨ ਸਾਡੇ ਘਰ ਅਤੇ ਮੇਰੀ ਭੈਣ ਤਾਂ ਆਪ ਖੁਦ ਬਾਹਰ ਨਹੀਂ ਸੀ ਜਾ ਸਕਦੀ ਇਸ ਕਰਕੇ ਉਹਨੇ ਮੈਨੂੰ ਕਿਹਾ ਕਿ ਤੂੰ ਇਹਨਾਂ ਨੂੰ ਘਰ ਬੈਠੇ ਹੀ ਕੁਛ ਮੰਗਵਾ ਦੇ ਅਤੇ ਮੈਂ ਵੀ ਕੁਝ ਇਸ ਤਰ੍ਹਾਂ ਹੀ ਕੀਤਾ ਅਤੇ ਗੱਲ ਕੁਝ ਇਸ ਤਰ੍ਹਾਂ ਹੋਈ ਕਿ ਉਸ ਟਾਈਮ ਹੀ ਮੇਰੇ ਦੋਸਤ ਨੇ ਮੇਰੇ ਤੋਂ ਤਿੰਨ ਹਜ਼ਾਰ ਰੁਪਈਆ ਮੰਗ ਲਿਆ ਮੇਰੇ ਅਕਾਊਂਟ ਵਿੱਚ ਸਿਰਫ ਬੱਤੀ ਸੌ ਰੁਪਏ ਸਨ ਜਿਸ ਕਰਕੇ ਉਹ ਮੇਰਾ ਬਹੁਤ ਹੀ ਨਜ਼ਦੀਕੀ ਦੋਸਤ ਸੀ ਅਤੇ ਮੈਂ ਵੀ ਉੱਧਰ ਔਡਰ ਕੀਤਾ ਹੋਇਆ ਸੀ ਜਿਸ ਕਰਕੇ ਕੈਸ਼ ਔਨ ਡਿਲੀਵਰੀ ਦੀ ਓਪਸ਼ਨ ਵੀ ਉੱਥੇ ਆ ਹੀ ਨਹੀਂ ਰਹੀ ਸੀ ਅਤੇ ਮੈਂ ਆਪਣੀ ਭੈਣ ਨਾਲ ਗੱਲ ਕਰਕੇ ਕਿਹਾ ਕਿ ਉੱਥੇ ਕੈਸ਼ ਔਨ ਡਿਲੀਵਰੀ ਦੀ ਓਪਸ਼ਨ ਨਹੀਂ ਹੈ ਅਤੇ ਮੇਰੇ ਕੋਲ ਪੈਸੇ ਵੀ ਨਹੀਂ ਹਨ ਤਾਂ ਫਿਰ ਮੈਨੂੰ ਉਹਨੇ ਕਿਹਾ ਕਿ ਤੂੰ ਉਸਨੂੰ ਕੈਂਸਲ ਕਰਦੇ ਜਿਸ ਕਾਰਨ ਮੈਂ ਕੈਸ਼ ਔਨ ਡਿਲੀਵਰੀ ਨਹੀਂ ਕਰ ਸਕਿਆ ਅਤੇ ਮੈਂ ਉਸ ਔਡਰ ਨੂੰ ਕੈਂਸਲ ਕਰ ਦਿੱਤਾ ਅਤੇ ਮੈਂ ਖੁਦ ਬਾਜ਼ਾਰ ਜਾ ਕੇ ਆਪਣੀ ਭੈਣ ਹੋਰਾਂ ਲਈ ਖਾਣ ਪੀਣ ਲਈ ਚੀਜ਼ਾਂ ਲੈ ਕੇ ਆਇਆ